ਜੇ ਅਸੀਂ ਬ੍ਰਹਿਮੰਡ ਦੀ ਗੱਲ ਕਰੀਏ ਤਾਂ ਸਾਡੇ ਜਿਹੜਾ ਬ੍ਰਹਿਮੰਡ ਹੈਗਾ ਇਹਦਾ ਕੋਈ ਇੱਕ ਰਹੱਸ ਨਹੀਂ ਇਹਦੇ ਬਹੁਤ ਜ਼ਿਆਦਾ ਰਹੱਸ ਹੈਗੇ ਆ ਜਿਵੇਂ ਜਿਵੇਂ ਕੁਝ ਕੁ ਰਹੱਸਿਆਂ ਦੀ ਆਪਾਂ ਗੱਲ ਕਰੀਏ ਜਿਵੇਂ ਆਪਾਂ ਧਰਤੀ ਦੇ ਉੱਪਰ ਰਹਿੰਦੇ ਹਾਂ ਇਸ ਤਰ੍ਹਾਂ ਆਪਾਂ ਨੂੰ ਇਹ ਵੀ ਨਹੀਂ ਨਾ ਪਤਾ ਨੀਚੇ ਵੀ ਧਰਤੀ ਇੱਕ ਹੋਰ ਧਰਤੀ ਵੀ ਹੋ ਸਕਦੀ ਆ ਜਿੱਥੇ ਜੀਵਨ ਸੰਭਵ ਹੋਵੇ ਲੋਕ ਰਹਿੰਦੇ ਹੋਣ ਜਿਸ ਤਰ੍ਹਾਂ ਆਪਾਂ ਰਹਿੰਦੇ ਹੈਗੇ ਹੈਗੇ ਠੀਕ ਹੈ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣ ਨੀਚੇ ਧਰਤੀ ਹੋ ਸਕਦੀ ਆ ਨੀਚੇ ਤੋਂ ਨੀਚੇ ਜਿਵੇਂ ਆਪਾਂ ਨੇ ਲੋਕ ਕਹਿ ਦਿੰਦੇ ਆ ਪਤਾਲ ਲੋਕ 'ਚ ਗਿਆ ਪਤਾਲ ਬਣਿਆ ਹੋਇਆ ਹੈਗਾ ਨੀਚੇ ਬਲੇਕ ਇਸ ਤਰ੍ਹਾਂ ਠੀਕ ਹੈ ਆਪਣਾ ਇੱਕ ਇਹ ਵੀ ਰਹੱਸ ਹੈ ਰਹੱਸ ਹੈਗਾ ਗਾ ਵੀ ਮਨੁੱਖ ਜਿਹੜਾ ਹੈਗਾ ਮਰਨ ਤੋਂ ਬਾਅਦ ਉਹ ਕੀ ਬਣਦਾ ਹੈਗਾ ਗਾ ਜਿਵੇਂ ਕੋਈ ਆਪਣੇ ਸੁਣਨ ਵਿੱਚ ਆਇਆ ਵੀ ਉਹ ਨਰਕ ਦੇ ਵਿੱਚ ਚਲਾ ਜਾਂਦਾ ਸਵਰਗ ਦੇ ਵਿੱਚ ਵੀ ਚਲਾ ਜਾਂਦਾ ਜਾਂ ਉਹਦੀ ਆਤਮਾ ਹੁੰਦੀ ਆ ਉਹਨੂੰ ਕੋਈ ਲੈਣ ਆਉਂਦਾ ਇਹ ਵੀ ਅਜੇ ਤੱਕ ਬਹੁਤ ਵੱਡਾ ਰਹੱਸ ਹੈਗਾ ਗਾ ਵੀ ਕਿਸ ਤਰ੍ਹਾਂ ਹੈਗਾ ਗਾ ਵੀ ਕੀ ਹੁੰਦਾ ਹੈਗਾ ਗਾ ਸੋ ਆਪਾਂ ਰਹੱਸ ਜਿਹੜੇ ਹੈਗੇ ਬ੍ਰਹਿਮੰਡ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਰਹੱਸ ਜਿਹੜੇ ਹੈਗੇ ਹਨ ਹੈਗੇ ਹਨ ਅਤੇ ਵੀ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਵੀ ਜਿਹੜਾ ਹੈਗਾ ਗਾ ਮਨੁੱਖ ਹੈਗਾ ਜਨਮ ਮਰਨ ਤੋਂ ਬਾਅਦ ਉਹ ਜਾਨਵਰ ਰੂਪ ਭੇਟ ਜਾਨਵਰ ਬਣਦਾ ਹੈਗਾ ਜਾਂ ਜਨਮ ਲੈਣ ਤੋਂ ਪਹਿਲਾਂ ਜਿਹੜਾ ਹੈਗਾ ਉਹ ਉਹ ਸੀਗਾ ਜਿਹੜਾ ਹੈਗਾ ਗਾ ਵੀ ਬਹੁਤ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਜੂਨਾਂ ਜਿਹੜੀਆਂ ਭੋਗ ਕੇ ਜਿਹੜਾ ਹੈਗਾ ਉਹ ਮਨੁੱਖ ਦੀ ਜੂਨ ਦੇ ਵਿੱਚ ਗਿਆ ਸੁਣਨ ਦੇ ਵਿੱਚ ਜਿਵੇਂ ਆਇਆ ਹੈਗਾ ਜਿਵੇਂ ਚੁਰਾਸੀ ਲੱਖ ਜੂਨਾਂ ਜਿਹੜੀਆਂ ਹੈਗੀਆਂ ਕੱਟ ਕੇ ਜਿਹੜਾ ਹੈ ਇੱਕ ਮਨੁੱਖੀ ਰੂਪ ਮਿਲਦਾ ਹੈਗਾ ਬਟ ਇਹ ਅੱਜ ਤੱਤ ਇਸ ਦੇ ਉੱਤੇ ਕਿਸੇ ਨੇ ਵੀ ਕੋਈ ਪੁਸ਼ਟੀ ਨਹੀਂ ਕੀਤੀ ਵੀ ਇਹ ਅਸਲ ਵਿੱਚ ਇਹੀ ਸੱਚ ਆ ਇਹ ਸੁਣਨ ਦੇ ਵਿੱਚ ਆਇਆ ਹੈ ਇਹ ਇੱਕ ਬ੍ਰਹਿਮੰਡ ਦਾ ਬਹੁਤ ਵੱਡਾ ਵੱਡਾ ਰਹੱਸ ਆ ਵੀ ਮਨੁੱਖ ਨੂੰ ਜਨਮ ਕਿਵੇਂ ਮਿਲਦਾ ਕਿੱਥੋਂ ਮਿਲਦਾ ਜਾਂ ਜਨਮ ਤੋਂ ਬਾਅਦ ਮਰਨ ਤੋਂ ਬਾਅਦ ਉਹਦਾ ਕੀ ਹੁੰਦਾ ਹੈਗਾ ਇਹ ਅੱਜ ਤੱਕ ਇੱਕ ਰਹੱਸ ਹੈਗਾ ਸੋ ਸਾਡੇ ਬ੍ਰਹਿਮੰਡ ਦੇ ਜਿਹੜੇ ਹੈਗੇ ਹੈਗੇ ਇੱਕ ਨਹੀਂ ਬਹੁਤ ਜ਼ਿਆਦਾ ਰਹੱਸ ਰਹੱਸ ਹੈਗੇ ਜੇ ਅਸੀਂ ਇਹਨਾਂ 'ਤੇ ਗੱਲ ਕਰੀਏ ਤਾਂ ਸਾਨੂੰ ਜਿਹੜੇ ਹੈਗੇ ਬਹੁਤ ਰਹੱਸ ਜਿਹੜੇ ਹੈਗੇ ਹੈਗੇ ਦੇਖਣ ਨੂੰ ਅਤੇ ਸੁਣਨ ਨੂੰ ਮਿਲਣਗੇ